ਪਿਛਲੇ ਸਾਲਾਂ ਵਿੱਚ ਸਰਫਿੰਗ ਦੀ ਖੇਡ ਦਾ ਵਿਕਾਸ ਬੇਹੱਦ ਤੇਜੀ ਨਾਲ ਹੋਇਆ ਹੈ ਪ੍ਰੋਫੈਸ਼ਨਲ ਸਰਫਰ ਸਰਫਿੰਗ ਦੇ ਪ੍ਰਚਾਰ ਸ਼ਿਕਾਰਾਂ ਅਤੇ ਮਹਾਨ ਸਰਫਰ ਦੀਆਂ ਖੇਡਾਂ ਲਈ ਸਮਾਰਟ ਤਕਨੀਕੀ ਉਪਯੋਗ ਕੀਤੇ ਹਨ ਇਸ ਵਿਕਾਸ ਨੇ ਸਰਫਰਾਂ ਨੂੰ ਹੋਰ ਅਨੁਭਵ ਅਤੇ ਸੁਵਿਧਾਵਾਂ ਦੀ ਪ੍ਰਧਾਨਤਾ ਦਿੱਤੀ ਹੈ ਅਤੇ ਉਨਾਂ ਨੂੰ ਖੇਡ ਵਿੱਚ ਹੋਰ ਪ੍ਰੋਫੈਸ਼ਨਲ ਅਤੇ ਸਫ਼ਲ ਬਣਨ ਲਈ ਮਦਦ ਕੀਤੀ ਹੈ ਵਧੇਰੇ ਲੋਕ ਇਸ ਖੇਡ ਨੂੰ ਅਪਣਾਉਂਦੇ ਹਨ ਅਤੇ ਇਸ ਨੂੰ ਇੱਕ ਤੋਂ ਵਧੇਰੇ ਔਰਤਾਂ ਅਤੇ ਨੌਜਵਾਨ ਵਿੱਚ ਇਸ ਨੂੰ ਲੋਕਪ੍ਰਿਅਤਾ ਮਿਲ ਗਈ ਹੈ ਵਧੇਰੇ ਟੂਰਨਾਮੈਂਟਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਖੇਡ ਦੀ ਪ੍ਰਸਿੱਧਤਾ ਵੱਧ ਰਹੀ ਹੈ